ਮੈਨੂੰ ਪੇਂਟ ਕਰਨਾ ਬਚਪਨ ਤੋਂ ਹੀ ਬਹੁਤ ਪਸੰਦ ਹੈ ਮੈਂ ਜਦੋਂ ਬਚਪਨ ਵਿੱਚ ਪੇਂਟ ਕਰਦੀ ਹੁੰਦੀ ਸੀ ਤਾਂ ਮੈਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਸਨ ਮੈਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਉਸ ਸਮੇਂ ਵਿੱਚ ਪੇਂਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਸੀ ਅਤੇ ਅਸੀਂ ਬਹੁਤ ਜ਼ਿਆਦਾ ਪਿਛੜੇ ਹੋਏ ਇਲਾਕੇ ਵਿੱਚ ਰਹਿੰਦੇ ਸੀ ਉੱਥੇ ਪੇਂਟਿੰਗ ਦਾ ਸਮਾਨ ਬਹੁਤ ਘੱਟ ਮਿਲਦਾ ਸੀ ਹਾਲਾਂਕਿ ਮਿਲਦਾ ਹੀ ਨਹੀਂ ਸੀ ਸਾਨੂੰ ਬਹੁਤ ਦੂਰ ਸ਼ਹਿਰ ਵਿੱਚ ਜਾ ਕੇ ਸਮਾਨ ਖਰੀਦਣਾ ਪੈਂਦਾ ਸੀ ਅਤੇ ਜਦੋਂ ਵੀ ਮੈਂ ਆਪਣੇ ਪਿਤਾ ਜੀ ਨਾਲ ਸ਼ਹਿਰ ਆਉਂਦੀ ਸੀ ਤਾਂ ਮੈਂ ਇੱਕ ਪੇਂਟ ਵਾਲੀ ਬੁੱਕ ਅਤੇ ਅਤੇ ਕਲਰ ਖਰੀਦਦੀ ਹੁੰਦੀ ਸੀ ਤੇ ਉਹ ਪੇਂਟਿੰਗ ਮੈਨੂੰ ਲੈ ਕੇ ਬਹੁਤ ਖੁਸ਼ੀ ਹੁੰਦੀ ਸੀ ਅਤੇ ਪਰ ਜਦੋਂ ਵੀ ਉਹ ਖਤਮ ਹੁੰਦੇ ਸੀ ਮੈਨੂੰ ਬਹੁਤ ਦੁੱਖ ਹੁੰਦਾ ਸੀ ਮੈਂ ਆਪਣੀਆਂ ਪੇਂਟਿੰਗਾਂ ਨੂੰ ਸੋਸ਼ਲ ਮੀਡੀਆ 'ਤੇ ਦਿਖਾਉਣਾ ਚਾਹੁੰਦੀ ਸੀ ਕਿ ਮੈਂ ਇੰਨੀ ਸੋਹਣੀ ਪੇਂਟ ਕਰਦੀ ਹਾਂ ਪਰ ਮੈਂ ਨਹੀਂ ਦਿਖਾ ਪਾਉਂਦੀ ਸੀ ਕਿਉਂਕਿ ਉਸ ਸਮੇਂ ਇੱਦਾਂ ਦਾ ਕੁਝ ਵੀ ਨਹੀਂ ਹੁੰਦਾ ਸੀ